ਸਤਿ ਸ਼੍ਰੀ ਅਕਾਲ ਜੀ ਤਰਨ ਤਾਰਨ ਸ਼ਹਿਰ ਵਿੱਚ ਜਿਹੜੀਆਂ ਧਾਰਮਿਕ ਛੁੱਟੀਆਂ ਹਨ ਜਿਵੇਂ ਗੁਰੂ ਸਾਹਿਬਾਂ ਦਾ ਜਨਮ ਦਿਵਸ ਹੈ ਇਹ ਮਨਾਇਆ ਜਾਂਦਾ ਹੈ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇੱਥੇ ਸ਼ਹਿਰ ਦੇ ਵਿੱਚ ਸਕੂਲਾਂ ਕਾਲਜਾਂ ਅਤੇ ਗਤਕਾ ਪਾਰਟੀਆਂ ਵੱਲੋਂ ਨਗਰ ਕੀਰਤਨ ਕੱਢੇ ਜਾਂਦੇ ਹੈ ਅਤੇ ਇਹ ਥਾਵਾਂ ਥਾਵਾਂ 'ਤੇ ਜਿਸ ਰੂਟ ਦੁਆਰਾ ਹੁੰਦਾ ਉੱਥੇ ਘੁੰਮ ਕੇ ਗੁਰਦੁਆਰਾ ਸਾਹਿਬ ਇਹ ਵਾਪਸ ਜਾਂਦਾ ਹੈ ਇਸ ਤੋਂ ਇਲਾਵਾ ਇੱਥੇ ਲੰਗਰ ਵੀ ਵਰਤਾਏ ਜਾਂਦੇ ਹਨ ਉਹ ਧਾਰਮਿਕ ਜਿਹੜੇ ਪੱਖੋਂ ਹੈ ਉਹ ਪੰਜਾਬ ਸ਼ੁਰੂ ਤੋਂ ਹੀ ਸਰਬ ਪੱਖੀ ਰਿਹਾ ਹੈ ਅਤੇ ਇਸ ਲਈ ਇਹ ਲੋਕਾਂ ਵਿੱਚ ਦਾਨ ਪੁੰਨ ਦੀ ਮਹੱਤਤਾ ਬਹੁਤ ਹੁੰਦੀ ਹੈ ਧਾਰਮਿਕ ਛੁੱਟੀਆਂ ਵਿੱਚ ਜਿਹੜੀ ਤਰਨ ਤਾਰਨ ਸਾਹਿਬ ਵਿੱਚ ਮੱਸਿਆ ਬਹੁਤ ਵੱਡੀ ਲੱਗਦੀ ਹੈ ਇਹ ਇਸ ਤੋਂ ਇਲਾਵਾ ਜਿਹੜੇ ਇਹ ਆਉਂਦੇ ਰੀਤੀ ਰਿਵਾਜ਼ ਅਤੇ ਅਸੀਂ ਜਿਵੇਂ ਮਤਲਬ ਕਿ ਲੋਕ ਲੋਹੜੀ ਦਾ ਤਿਹਾਰ ਹੈ ਇਹ ਬਹੁਤ ਧੂਮਧਾਮ ਨਾਲ ਲੋਕ ਮਨਾਉਂਦੇ ਹਨ ਉਹਨੂੰ ਬੱਚੇ ਜਿਹੜੇ ਨੇ ਗੁੱਡੀਆਂ ਪਤੰਗਾਂ ਉਡਾਉਂਦੇ ਹਨ ਲੋਹੜੀ ਬਾਲ਼ੀ ਜਾਂਦੀ ਹੈ ਹੋਲੀ ਏ ਇਹ ਵੀ ਬਹੁਤ ਮਨਾਈ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੀ ਹੈ ਜੀ ਦਿਵਾਲੀ ਵੀ ਬਹੁਤ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਇਹ ਜਿਹੜੇ ਸਾਡੇ ਜਿੰਨੇ ਵੀ ਤਿਉਹਾਰ ਹੈ ਉਹ ਖਾਸ ਕਰਕੇ ਰੀ ਧਾਰਮਿਕ ਪਾਸੇ ਜ਼ਿਆਦਾ ਜੁੜੇ ਹੋਏ ਹਨ ਅਤੇ ਇਹ ਹਰ ਕੋਈ ਜੋ ਵੀ ਹੈ ਆਪਣੀ ਸ਼ਰਧਾ ਮੁਤਾਬਕ ਦਾਨ ਪੁੰਨ ਵੀ ਕਰਦਾ ਹੈ ਅਤੇ ਬਾਕੀ ਪੁਰਾਤਨ ਤਰੀਕੇ ਨਾਲ ਹੀ ਇਹ ਸਾਰੇ ਬੰਨ੍ਹੇ ਹੋਏ ਲੋਕ ਹਨ ਅਤੇ ਇਹ ਆਪਣੇ ਨਿੱਜੀ ਆਪਣੇ ਆਪ ਨੂੰ ਅਨੁਸ਼ਾਸਿਤ ਰਹਿ ਕੇ ਹੀ ਇਹ ਸਾਰੇ ਲੋਕ ਕੰਮ ਕਰਦੇ ਹਨ